ਹਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹ ਨਹੀਂ ਕੀਤਾ ਜਾਂਦਾ ਇਹ ਮੈਂ ਦੇਖਦਾ ਹਾਂ ਸਾਨੂੰ ਸਕੂਲ ਲੈਵਲ ਤੋਂ ਜਾਂ ਪਿੰਡ ਲੈਵਲ ਤੋਂ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਸਕੂਲ ਲੈਵਲ 'ਤੇ ਛੋਟੇ ਛੋਟੇ ਸਕੂਲ ਲੈਵਲ 'ਤੇ ਛੋਟੇ ਛੋਟੇ ਕੰਪੀਟੀਸ਼ਨ ਕਰਵਾਉਣੇ ਚਾਹੀਦੇ ਹਨ ਜੇ ਪਿੰਡ ਲੈਵਲ 'ਤੇ ਤਾਂ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਜਿਹਨਾਂ ਨਾਲ ਕਿ ਬੱਚਿਆਂ 'ਚ ਉਤਸ਼ਾਹ ਪੈਦਾ ਹੋਵੇ ਦੂਜੀ ਗੱਲ ਆ ਗਈ ਸਹੂਲਤਾਂ ਦੀ ਜੇ ਤੁਸੀਂ ਉਤਸ਼ਾਹਿਤ ਉਤਸ਼ਾਹਿਤ ਬੱਚਿਆਂ ਨੂੰ ਕਰੂੰਗੇ ਤਾਂ ਤੁਹਾਨੂੰ ਵਧੀਆ ਸਹੂਲਤਾਂ ਵੀ ਦੇਣੀਆਂ ਪੈਣਗੀਆਂ ਪਰ ਉਹ ਨਹੀਂ ਮਿਲਦੀਆਂ ਉਹ ਕਿਉਂ ਨਹੀਂ ਮਿਲਦੀਆਂ ਜਾਂ ਤਾਂ ਪਿੰਡਾਂ ਵਿੱਚ ਜ਼ਿਆਦਾ ਦੋ ਧੜੇ ਬਣ ਗਏ ਸਕੂਲਾਂ ਵਿੱਚ ਜਾਂ ਕੋਈ ਪੀਟੀਆਈ ਆ ਜਾਂ ਡੀਪੀਆਈ ਆ ਹਰੇਕ ਬੰਦਾ ਸੋਚਦਾ ਵੀ ਹਾਂ ਠੀਕ ਆ ਮੇਰੀ ਨੌਕਰੀ ਠੀਕ ਆ ਬੱਸ ਠੀਕ ਆ ਬੱਚਿਆਂ ਨੂੰ ਨਾ ਪਰ ਇਹ ਸੋਚ ਨਹੀਂ ਰੱਖਣੀ ਚਾਹੀਦੀ ਮੈਂ ਚਾਹੁੰਦਾ ਹਾਂ ਕਿ ਛੋਟੇ ਲੈਵਲ ਦੇ ਜੇ ਪਿੰਡਾਂ ਵਿੱਚ ਆ ਤਾਂ ਟੂਰਨਾਮੈਂਟ ਕਰਵਾਏ ਜਾਣ ਕਰਵਾਏ ਜਾਣ ਖੇਡਾਂ ਦੀ ਜਿਵਾਂ ਜਿੱਦਾਂ ਵੀ ਤੁਹਾਡੇ ਪਿੰਡਾਂ 'ਚ ਤੁਹਾਡੇ ਪਿੰਡਾਂ ਦਾ ਰੁਝਾਨ ਆ ਫੁੱਟਬਾਲ ਵਿੱਚ ਐਥਲੈਟਿਕ ਦੇ ਈਵੈਂਟਸ ਕਰਵਾਏ ਜਾਣ ਪਿੰਡਾਂ ਦੇ ਇਹ ਤਾਂ ਹੋ ਗਈ ਪਿੰਡ ਲੈਵਲ ਦੀ ਗੱਲ ਪਿੰਡਾਂ ਵਿੱਚ ਜੇ ਸਕੂਲ ਲੈਵਲ 'ਤੇ ਆ ਸਕੂਲ ਲੈਵਲ 'ਤੇ ਤੁਸੀਂ ਗਰੁੱਪ ਬਣਾ ਕੇ ਜਾਂ ਤੁਸੀਂ ਹਾਊਸਿਸ ਬਣਾ ਕੇ ਹਾਊਸਿਸਾਂ 'ਚ ਕੰਪੀਟੀਸ਼ਨ ਕਰਵਾਏ ਜਾਣ ਕਿ ਬੱਚਿਆਂ ਨੂੰ ਦੇਖਿਆ ਜਾਵੇ ਵੀ ਕਿਹੜਾ ਬੱਚਾ ਕਿੱਦਾਂ ਦੇ ਕੈਲੀਵਰ ਦਾ ਹੈ ਤਾਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ